ਹਾਂਜੀ ਗੱਲ ਕਰਦੇ ਹਾਂ ਆਪਾਂ ਵੀ ਤੁਹਾਨੂੰ ਕੋਈ ਇਹੋ ਜਿਹੀ ਕਿਤਾਬ ਮਿਲੀ ਹੈ ਜੋ ਉਸਨੇ ਤੁਹਾਨੂੰ ਉਕਸਾਇਆ ਹੋਵੇ ਜਾਂ ਸੋਚਣ ਲਈ ਮਜਬੂਰ ਕੀਤਾ ਹੋਵੇ ਹਾਂ ਬਿਲਕੁਲ ਇਸਦੇ ਵਿੱਚ ਕੋਈ ਦੋਰਾਏ ਨਹੀਂ ਹੈ ਮੈਨੂੰ ਇੱਕ ਕਿਤਾਬ ਦੇਖੀ ਆ ਪੜ੍ਹੀ ਆ ਮੈਂ ਉਹ ਉਹ ਹੈਗਾ ਸਾਕਾ ਨੀਲਾ ਤਾਰਾ ਸਾਕਾ ਨੀਲਾ ਤਾਰਾ ਦੇ ਵਿੱਚ ਜੋ ਕਿ ਸਾਡੇ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਸੀਗਾ ਉਸ ਨਾਲ ਸ ਮੈਨੂੰ ਬਹੁਤ ਜ਼ਿਆਦਾ ਆਪਣੇ ਆਪ 'ਤੇ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਕਿ ਕਿਸ ਦੇਸ਼ ਦੇ ਵਾਸੀ ਹਾਂ ਸਾਡੇ ਦੇ ਉੱਪਰ ਅਟੈਕ ਸਾਡੇ ਐਡੇ ਵੱਡੇ ਅਸਥਾਨ ਦੇ ਉੱਪਰ ਅਟੈਕ ਉਹ ਵੀ ਟੈਂਕਾਂ ਨਾਲ ਉਹ ਵੀ ਤੋਪਾਂ ਨਾਲ ਐਡੇ ਆਪਣੀ ਫੌਜ ਨੇ ਸਾਡੇ ਖੁਦ ਅਸੀਂ ਭਾਰਤ ਦੇ ਵਸਨੀਕ ਹੁੰਦੇ ਹੋਏ ਸਾਡੇ ਪਰ ਇੰਨੀ ਦੁਵਿਧਾ ਦਾ ਸਾਹਮਣਾ ਉਸ ਟਾਈਮ ਸਾਨੂੰ ਕਰਨਾ ਪਿਆ ਸਾਨੂੰ ਸਾਡੇ ਬੱਚੇ ਸ਼ਹੀਦ ਹੋ ਗਏ ਕਈ ਨਸਲਾਂ ਸਾਡੇ ਪਰਿਵਾਰਾਂ ਦੀਆਂ ਖਤਮ ਹੋ ਗਈਆਂ ਕਿਉਂਕਿ ਉਸ ਟਾਈਮ ਉਹਨਾਂ ਨੇ ਜਦੋਂ ਗੋਲੀਆਂ ਜਦੋਂ ਚਲਦੀਆਂ ਹੁੰਦੀਆਂ ਉਹ ਕੋਈ ਮੂਹਰੇ ਬੰਦਾ ਇਹ ਨਹੀਂ ਦੇਖਦੇ ਵੀ ਬੰਦਾ ਕੌਣ ਹੈ ਕੌਣ ਨਹੀਂ ਉਸਨੇ ਸਿਰਫ ਬ ਬੰਦੇ ਦੀ ਜਾਨ ਲੈਣੀ ਹੁੰਦੀ ਹੈ ਅਸੀਂ ਉਹ ਚਾਹੁੰਦੇ ਵੀ ਉਹ ਗੋਲੀਆਂ ਕਾਹਦੇ ਵਾਸਤੇ ਬਣੀਆਂ ਸੀਗੀਆਂ ਆਪਣੇ ਧਰਮ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਹੀ ਇਹ ਕਿਉਂ ਵਰਤੀਆਂ ਗਈਆਂ ਇਸ ਲਾ ਸਾਨੂੰ ਮੈਨੂੰ ਉਸ ਟਾਈਮ ਨੂੰ ਬਹੁਤ ਜ਼ਿਆਦਾ ਆਪਣੇ ਮੇਰੇ ਦਿਮਾਗ 'ਤੇ ਡੂੰਘਾ ਅਸਰ ਪਾਇਆ ਇਹ ਪ੍ਰਧਾਨ ਮੰਤਰੀ ਨੇ ਜੋ ਇੰਦਰਾ ਗਾਂਧੀ ਨੇ ਫੈਸਲਾ ਲਿਆ ਸੀਗਾ ਉਹ ਬਹੁਤ ਹੀ ਜ਼ਿਆਦਾ ਗਲਤ ਲਿਆ ਸੀਗਾ ਹਾਂ ਦੂਜਾ ਗੱਲ ਕਰਦੇ ਹਾਂ ਆਪਾਂ ਕਿਤਾਬ ਰੀਡਿੰਗ ਵਿੱਚ ਕਲੱਬ ਸ਼ਾਮਿਲ ਹੋਣ ਦੀ ਹਾਂ ਮ ਜਦੋਂ ਪਿੱਛੇ ਜਿਹੇ ਦਿੱਲੀ ਦੇ ਵਿੱਚ ਸੈਮੀਨਾਰ ਹੋਇਆ ਸੀਗਾ ਉਸ ਦੇ ਵਿੱਚ ਮੈਂ ਅਤੇ ਮੇਰਾ ਦੋਸਤ ਗੁਰਬਹਾਰ ਜੋ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਹੈ ਐਂਡ ਮੇਰਾ ਦੋਸਤ ਬਲਵਿੰਦਰ ਅਸੀਂ ਸ਼ਾਮਿਲ ਹੋਏ ਸੀਗੇ ਅਸੀਂ ਉਸਦੇ ਵਿੱਚ ਆਪਣੀਆਂ ਕਿਤਾਬਾਂ ਜ਼ਰੂਰ ਰੀਡਿੰਗ ਕੀਤੀਆਂ ਸਾਨੂੰ ਉਸ ਦੇ ਵਿੱਚ ਨਾਲ ਗਰਬ ਮਹਿਸੂਸ ਹੋਇਆ ਅਸੀਂ ਕਿਤਾਬਾਂ ਆਪਣੀਆਂ ਇੱਥੋਂ ਪੰਜਾਬ ਦੇ ਤਰਫੋਂ ਵੀ ਲੈ ਕੇ ਗਏ ਸੀਗੇ ਅਸੀਂ ਵੀ ਜੋ ਸਾਡਾ ਇਤਿਹਾਸ ਆ ਉਹ ਜਿਹੜੇ ਹੋਰ ਉੱਥੇ ਦੇ ਆਪਣਾ ਰੀਡ ਕਰਨ ਆਏ ਵੀ ਸੀਗੇ ਉਹਨਾਂ ਨੂੰ ਵੀ ਅਸੀਂ ਆਪਣੀ ਕਿਤਾਬਾਂ ਪੜ੍ਹਾ ਸਕੀਏ ਉਹ ਸਾਡੇ ਕਿਤਾਬਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ